ਮੈਨੂੰ ਪੌਦੇ ਲਗਾਉਣ ਦਾ ਬਹੁਤ ਸ਼ੌਕ ਹੈਗਾ ਗਰੀਨਰੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਸਾਰੇ ਪਾਸੇ ਫੁੱਲ ਲੱਗੇ ਹੋਣ ਵਧੀਆ ਅੰਦਰ ਵੀ ਬਾਹਰ ਵੀ ਵਿਹੜੇ 'ਚ ਵੀ ਹੋਣ ਅਤੇ ਸਬਜ਼ੀਆਂ ਵਗੈਰਾ ਲਾਉਣ ਦਾ ਵੀ ਮੈਨੂੰ ਬਹੁਤ ਸ਼ੌਕ ਹੈਗਾ ਜਿਵੇਂ ਬੈਂਗਣੀ ਸ਼ਿਮਲਾ ਮਿਰਚ ਟਮਾਟਰ ਪੁਦੀਨਾ ਅਤੇ ਧਨੀਆ ਇਹ ਚੀਜ਼ਾਂ ਗਮਲਿਆਂ 'ਚ ਵੀ ਹੋ ਜਾਂਦੀਆਂ ਕਿਉਂਕਿ ਅੱਜ ਕੱਲ੍ਹ ਸ਼ਹਿਰਾਂ 'ਚ ਸਾਰਿਆਂ ਦੇ ਪੱਕੀ ਜਗ੍ਹਾ ਹੁੰਦੀ ਹੈਗੀ ਕੱਚੀ ਜਗ੍ਹਾ ਹੁੰਦੀ ਨੀਗੀ ਅਤੇ ਜਿਵੇਂ ਪੁਦੀਨੇ ਦੀ ਚਟਨੀ ਸਾਰੇ ਖਾ ਕੇ ਖੁਸ਼ ਹੁੰਦੇ ਹੈਗੇ ਹਰੇਕ ਸਬਜ਼ੀ 'ਚ ਧਨੀਆਂ ਪਾਓ ਵਧੀਆ ਉਹਦਾ ਟੇਸਟ ਬਣ ਜਾਂਦਾ ਅਤੇ ਪ ਪੁਦੀਨਾ ਜੇ ਆਪਾਂ ਬਾਜ਼ਾਰ 'ਚੋਂ ਲੈ ਕੇ ਆਉੇਂਦੇ ਹਾਂ ਤਾਂ ਗੁੱਟੀ ਮਿਲਦੀ ਹੈ ਵੇਸਟ ਜਾਂਦੀ ਹੈ ਉਹ ਤਾਂ ਨਾ ਹੀ ਉਹਦੀ ਕੋਈ ਖੁਸ਼ਬੂ ਹੁੰਦੀ ਹੈ ਨਾ ਹੀ ਵਧੀਆ ਸਵਾਦ ਘਰੋਂ ਚਾਰ ਪੱਤੇ ਤੋੜ ਕੇ ਤੁਸੀਂ ਬਣਾਓ ਵਧੀਆ ਲੱਗਦਾ ਅਤੇ ਫੁੱਲਾਂ ਵਾਲੇ ਬੂਟੇ ਵੀ ਐਂਈਂ ਹੁੰਦੇ ਆ ਉਹ 'ਚੋਂ ਕਈ ਬੂਟੇ ਇਹੋ ਜਿਹੇ ਹੁੰਦੇ ਜਿਹੜੇ ਬਾਹਰ ਲਾਉਣੇ ਆਪਾਂ ਅਤੇ ਕਈ ਹੁੰਦੇ ਆ ਜਿਹੜੇ ਅੰਦਰ ਲਾਉਣੇ ਹੈਗੇ ਜਿਹੜੇ ਬੂਟੇ ਅੰਦਰ ਲਾਉਣੇ ਉਹ ਛਾਂ 'ਚ ਪਏ ਰਹਿੰਦੇ ਉਹਨੂੰ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ ਜਾਂ ਸਪਰੇਅ ਵਾਲੀ ਬੋਟਲ 'ਚ ਹੀ ਪਾਣੀ ਪਾ ਕੇ ਥੋੜ੍ਹਾ ਛਿੜਕਾਅ ਕਰ ਦਿਉ ਨਾਲੇ ਪੱਤੇ ਸੋਹਣੇ ਸਾਫ ਹੋ ਜਾਂਦੇ ਹੈ ਅਤੇ ਨਾਲੇ ਵਧੀਆ ਰਹਿੰਦੇ ਆ ਅਤੇ ਬਾਹਰ ਹੁਣ ਜਿਵੇਂ ਐਨੀ ਗਰਮੀ ਹੋਈ ਪਈ ਹੈਗੀ ਤਾਂ ਬਾਹਰ ਵਾਲੇ ਬੂਟਿਆਂ ਨੂੰ ਪਾਣੀ ਦੀ ਵੀ ਜ਼ਿਆਦਾ ਲੋੜ ਹੁੰਦੀ ਛਾਂ ਦੀ ਵੀ ਲੋੜ ਹੁੰਦੀ ਆ ਉਹਨਾਂ ਨੂੰ ਅਤੇ ਕਈ ਵਾਰੀ ਬੂਟਿਆਂ 'ਚ ਕੋਈ ਮਾੜਾ ਮੋਟਾ ਕੀੜਾ ਵਗੈਰਾ ਪੈ ਜਾਂਦਾ ਜਿਵੇਂ ਸਿਉਂਕ ਜਿਹੀ ਨਿਕਲਣ ਲੱਗ ਜਾਂਦੀ ਹੈਗੀ ਤਾਂ ਫੇਰ ਆਪਾਂ ਨੂੰ ਉਹਦੇ 'ਤੇ ਕੋਈ ਦਵਾਈ ਵਗੈਰਾ ਵੀ ਛਿੜਕਣੀ ਪੈਂਦੀ ਹੈ ਅਤੇ ਹੁਣ ਇਹ ਦਵਾਈ ਦੀ ਵੀ ਮਿਕਦਾਰ ਦਾ ਤੁਹਾਨੂੰ ਆਈਡੀਆ ਹੋਣਾ ਚਾਹੀਦਾ ਵੀ ਕਿੰਨੀ ਹੁਣ ਇਹ ਨਹੀਂ ਜਿਵੇਂ ਮੋਨੋ ਸਪਰੇਅ ਆ ਤੁਸੀਂ ਚੱਕ ਕੇ ਸਾਰੇ ਬੂਟਿਆਂ 'ਤੇ ਛਿੜਕ ਦਈਏ ਆਪਾਂ ਤਾਂ ਬੂਟੇ ਸੜ ਹੀ ਜਾਣਗੇ ਸਾਰੇ ਇਸ ਲਈ ਇਹ ਬਹ ਬਹੁਤ ਪੌਦਿਆਂ ਬਾਰੇ ਆਪਾਂ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਵੀ ਕਿਹੜੇ 'ਚ ਕਿੰਨੀ ਕੁ ਮਾਤਰਾ ਚ ਆਪਾਂ ਦਵਾਈ ਪਾਉਣੀ ਹੈਗੀ ਆ ਅਤੇ ਐਵੇਂ ਹੀ ਸ਼ਿਮਲਾ ਮਿਰਚ ਵਗੈਰਾ ਕਈ ਵਾਰੀ ਜਿਵੇਂ ਫਲ ਲੱਗ ਫਲ ਲੱਗ ਜਾਂਦਾ ਪਰ ਉਹ ਝੜ ਜਾਂਦਾ ਅੱਗੋਂ ਬਣਦਾ ਨੀਗਾ ਉਹ ਇਸ ਲਈ ਇਹਨਾਂ 'ਤੇ ਵੀ ਸਾਨੂੰ ਥੋੜ੍ਹੀ ਬਹੁਤ ਕੋਈ ਨਾ ਕੋਈ ਦਵਾਈ ਵਗੈਰਾ ਦਾ ਛਿੜਕਾਅ ਕਰਨਾ ਪੈਂਦਾ ਹੈਗਾ ਅਤੇ ਸਮੇਂ ਸਮੇਂ 'ਤੇ ਇਹਨਾਂ ਦੀ ਕਟਿੰਗ ਵੀ ਕਰਨੀ ਪੈਂਦੀ ਹੈ ਨਹੀਂ ਤਾਂ ਬੂਟੇ ਉਈਂ ਕਈ ਵਧੀ ਜਾਂਦੇ ਰਹਿੰਦੇ ਆ ਜਾਂ ਆਸੇ ਪਾਸੇ ਨਦੀਨ ਹੋ ਜਾਂਦੇ ਹੈ ਐਨੇ ਉਹ ਨਦੀਨ ਵੀ ਕੱਟਣੇ ਜ਼ਰੂਰੀ ਹੁੰਦੇ ਹੈਗੇ